ਹਾਂਜੀ ਮੈਂ ਉੱਥੋਂ ਦੀ ਰਿਸੈਪਸ਼ਨਿਸਟ ਬੋਲ ਰਹੀ ਹਾਂ ਹਾਓ ਮੇ ਆਈ ਹੈਲਪ ਯੂ ਹਾਂਜੀ ਇੱਥੇ ਹਰ ਤਰ੍ਹਾਂ ਦੇ ਫੇਸ਼ੀਅਲ ਹੁੰਦੇ ਆ ਹੈਂਡਸ ਤੋਂ ਲੈ ਕੇ ਮਸ਼ੀਨਸ ਵਾਲੇ ਫੇਸ਼ੀਅਲ ਵੀ ਹੁੰਦੇ ਆ ਸਾਡਾ ਇੱਕ ਤਾਂ ਮੋਸਟ ਪਾਪੂਲਰ ਹੈਗਾ ਹਾਈਡਰਾਫੇਸ਼ੀਅਲ ਅਤੇ ਹਾਈਡਰਾਫੇਸ਼ੀਅਲ ਦੀ ਸਪੈਸ਼ਲਿਟੀ ਹੈ ਕਿ ਇਹ ਮਸ਼ੀਨਸ ਨਾਲ ਹੁੰਦਾ ਪਹਿਲੀ ਗੱਲ ਤਾਂ ਹੱਥਾਂ ਦਾ ਯੂਜ ਨਹੀਂ ਹੁੰਦਾ ਕਈ ਵਾਰੀ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੁੰਦੀ ਹੈ ਵੀ ਉਸ ਹਿਸਾਬ ਨਾਲ ਨਹੀਂ ਹੁੰਦਾ ਅਤੇ ਪਹਿਲੀ ਗੱਲ ਤਾਂ ਇਹ ਸਕਿਨ ਨੂੰ ਇਨਫੈਕਸ਼ਨ ਨਹੀਂ ਪ੍ਰੋਵਾਈਡ ਕਰੇਗਾ ਦੁਜੀ ਗੱਲ ਇਹ ਇੰਸਟੈਂਟ ਗਲੋ ਦਿੰਦਾ ਅਤੇ ਤੀਜੀ ਗੱਲ ਇਹ ਹੈ ਵੀ ਤੁਹਾਡੇ ਫੇਸ 'ਤੇ ਜਿਹੜੇ ਵਾਲ ਹੁੰਦੇ ਆ ਉਹਨਾਂ ਦੀ ਗਰੋਥ ਵੀ ਘੱਟ ਜਾਂਦੀ ਹੈ ਅਤੇ ਹਾਈਡਰਾਫੇਸ਼ੀਅਲ ਮੀਨ ਤੁਹਾਨੂੰ ਸੱਤ ਕੁ ਹਜ਼ਾਰ ਤੱਕ ਦਾ ਪੈ ਸਕਦਾ ਪਰ ਇਹਦੀ ਸਪੈਸ਼ਲਿਟੀ ਇੱਕ ਹੋਰ ਹੈ ਵੀ ਇਹ ਤੁਹਾਡਾ ਇੱਕ ਸੀਟਿੰਗ ਵਿੱਚ ਹੀ ਹੋ ਜਾਊਗਾ ਤੁਹਾਨੂੰ ਵਾਰ ਵਾਰ ਵਿਜਿਟ ਕਰਨ ਦੀ ਲੋੜ ਨਹੀਂ ਹੈਗੀ ਹਾਂਜੀ ਫੇਸ਼ੀਅਲ ਸਾਡੇ ਕੋਲ ਹਰ ਟਾਈਪ ਦਾ ਅਵੇਲੇਬਲ ਹੈ ਇਸ ਤੋਂ ਇਲਾਵਾ ਸਾਡੇ ਕੋਲ ਓ ਥਰੀ ਦਾ ਫੇਸ਼ੀਅਲ ਵੀ ਅਵੇਲੇਬਲ ਹੈਗਾ ਇਹ ਮੇਨਲੀ ਜੇ ਤੁਹਾਡੀ ਸਕਿਨ 'ਤੇ ਟੈਨ ਹੋਈ ਪਈ ਆ ਫੇਸ 'ਤੇ ਜਿਵੇਂ ਅੱਜ ਕੱਲ੍ਹ ਹੁੰਦੀ ਆ ਗਰਮੀਆਂ 'ਚ ਤਾਂ ਉਹਦੇ ਲਈ ਬਹੁਤ ਜ਼ਿਆਦਾ ਈਫੈਕਟਿਵ ਹੈਗਾ ਓ ਥਰੀ ਦੇ ਵਿੱਚ ਸਾਰਾ ਕੁਛ ਹੁੰਦਾ ਸਾਰਾ ਕਲੀਨਰ ਤੋਂ ਲੈ ਕੇ ਸ਼ੀਟ ਤੱਕ ਹੁੰਦਾ ਮਾਸਕ ਤੋਂ ਸਾਰਾ ਕੁਛ ਤੁਹਾਨੂੰ ਵਧੀਆ ਪ੍ਰੋਵਾਈਡ ਕੀਤਾ ਜਾਊਗਾ ਸਾਡੇ ਸਲੂਨ ਦੀ ਸਰਵਿਸ ਬਹੁਤ ਵਧੀਆ ਹੈਗੀ ਅਤੇ ਜੇ ਤੁਸੀਂ ਕੋਈ ਵੀ ਹੋਰ ਚੀਜ਼ ਕਰਵਾ ਇਸ ਤੋਂ ਇਲਾਵਾ ਜਿਹੜੇ ਵੀ ਫੇਸ਼ੀਅਲ ਤੁਸੀਂ ਜਿਹੜੇ ਮਰਜ਼ੀ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲ ਸਾਰੇ ਅਵੇਲੇਬਲ ਹੈ ਲੋਟਸ ਦਾ ਵੀ ਹੈ ਵੀ ਐਲ ਸੀ ਸੀ ਆ ਕੋਈ ਵੀ ਫੇਸ਼ੀਅਲ ਕਰਵਾਉਣਾ ਚਾਹੁੰਦੇ ਤਾਂ ਸਾਡੇ ਕੋਲ ਅਵੇਲੇਬਲ ਹੈ ਦੇਖੋ ਜੀ ਹੁਣ ਸਾਡੇ ਸਪੈਸ਼ਲ ਪੈਕੇਜਿਜ ਚੱਲਦੇ ਆ ਕਰਵਾ ਚੌਥ ਕਰਕੇ ਹਾਈਡਰਾਫੇਸ਼ੀਅਲ ਪੰਜ ਹਜ਼ਾਰ ਦਾ ਪਊਗਾ ਅਤੇ ਆਹ ਆਫਰ ਸਪ ਸਿਰਫ ਮੰਡੇ ਤੱਕ ਹੀ ਹੈ ਅਤੇ ਇਸ ਤੋਂ ਇਲਾਵਾ ਕਰਵਾਚੌਥ 'ਚ ਹੋਰ ਵੀ ਬਹੁਤ ਸਾਰੇ ਡਿਸਕਾਊਂਟ ਹੈਗੇ ਆ ਤੁਹਾਨੂੰ ਇੱਕ ਹਜ਼ਾਰ ਦੇ ਵਿੱਚ ਫੁੱਲ ਹੈਂਡ ਵੈਕਸਿੰਗ ਹਾਫ ਲੈਗ ਵੈਕਸਿੰਗ ਥਰੈਡਿੰਗ ਅਪਰ ਲਿਪਸ ਹੋ ਗਿਆ ਫੇਸ਼ੀਅਲ ਹੋ ਗਿਆ ਇੱਕ ਵੀ ਐਲ ਸੀ ਸੀ ਦਾ ਇਹ ਸਭ ਕੁਝ ਦਿੱਤਾ ਜਾਊਗਾ ਇਸ ਤੋਂ ਇਲਾਵਾ ਜੇਕਰ ਹੇਅਰ ਡੂ ਕਰਵਾਉਣਾ ਤਾਂ ਉਹ ਵੀ ਸਪੈਸ਼ਲ ਆਫਰਸ 'ਚ ਚੱਲ ਰਿਹਾ ਹੈ ਉਹ ਤੁਹਾਡਾ ਸਾਰਾ ਕੁਛ ਸੱਤ ਸੌ ਵਿੱਚ ਕੀਤਾ ਜਾਊਗਾ ਅਤੇ ਇਸ ਅਤੇ ਮੈਡੀਕੇਯੁਰ ਪੈਡੀਕੇਯੁਰ ਕਰਵਾਉਣਾ ਤਾਂ ਉਹ ਵੀ ਕਰਵਾ ਸਕਦੇ ਹੋ ਸਾਡੇ ਸਲੋਨ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੈ ਹਾਂਜੀ ਇਹ ਸਾਡੀ ਹਾਂਜੀ ਇਸ ਸੈਟਰਡੇ ਵੈਸੇ ਐਲਮੋਸਟ ਫਰੀ ਹਾਂ ਤੁਸੀਂ ਬਾਰ੍ਹਾਂ ਕੁ ਵਜੇ ਤੱਕ ਆ ਸਕਦੇ ਹੋ ਦੇਖੋ ਜੀ ਹਾਈਡਰਾਫੇਸ਼ੀਅਲ ਮਸ਼ੀਨਸ ਨਾਲ ਹੁੰਦਾ ਤਾਂ ਅਪਰੋਕਸ ਇੱਕ ਡੇਢ ਘੰਟਾ ਤਾਂ ਲੱਗ ਹੀ ਜਾਂਦਾ ਤੁਹਾਨੂੰ ਇੰਸਟੈਂਟ ਗਲੋ ਪ੍ਰੋਵਾਈਡ ਹੋਊਗਾ ਤੁਹਾਨੂੰ ਅਸੀਂ ਪੂਰੀ ਸੈਟਿਸਫੈਕਸ਼ਨ ਦੇਵਾਂਗੇ ਹਾਂਜੀ ਜੀ ਮੋਸਟ ਵੈਲਕਮ ਤੁਸੀਂ ਸੈਟਰਡੇ ਆ ਜਿਓ ਓਕੇ ਜੀ